ਹਾਂ ਬਚਪਨ ਵਿੱਚ ਵੀ ਬਚਪਨ ਵਿੱਚ ਮੈਂ ਗਈ ਹਾਂ ਹਰੀਦੁਆ ਉੱਥੇ ਵਰਿੰਦਾਵਨ ਬਚਪਨ ਵਿੱਚ ਮੈਂ ਯਾਤਰਾ ਕੀਤੀ ਹੋਈ ਆ ਵਰਿੰਦਾਵਨ ਮੇਰੇ ਮੇਰੇ ਪੇ ਮਾਂ ਪਿਓ ਮੈਨੂੰ ਲੈ ਕੇ ਗਏ ਸੀ ਵਰਿੰਦਾਵਨ ਅਤੇ ਉੱਥੇ ਮੈਂ ਘੁੰਮੀ ਸੀ ਤਿੰਨ ਚਾਰ ਦਿਨ ਉੱਥੇ ਮੈਂ ਰਹੀ ਸੀ ਖਾਧਾ ਪੀਤਾ ਸੀ ਅਤੇ ਉੱਥੇ ਮੈਂ ਕਈ ਤਰ੍ਹਾਂ ਦੇ ਟੈਂਪਲਸ ਮੰਦਰ ਵੇਖੇ ਸੀ ਅਤੇ ਮੈਨੂੰ ਮੰਦਰ ਬਹੁਤ ਵਧੀਆ ਲੱਗਦੇ ਹਨ ਪਹਿਲੇ ਮੈਨੂੰ ਬੱਤੀ 'ਤੇ ਇੰਨਾਂ ਵਿਸ਼ਵਾਸ ਨਹੀਂ ਸੀ ਪਰ ਜਦੋਂ ਮੈਂ ਵਰਿੰਦਾਵਨ ਗਈ ਉਦੋਂ ਮੈਨੂੰ ਬੱਤੀ 'ਤੇ ਵਿਸ਼ਵਾਸ ਹੋਣ ਲੱਗ ਪਿਆ ਮੈਨੂੰ ਬੱਤੀ 'ਤੇ ਹੋਣ ਲੱਗ ਪਿਆ ਕਿ ਹਾਂ ਭਗਵਾਨ ਵੀ ਕੋਈ ਚੀਜ਼ ਆ ਭਗਵਾਨ ਦੀ ਵੀ ਸ਼ਰਧਾ ਭਗਤੀ ਭਾਵਾਂ ਤਾਂ ਕਰਕੇ ਪੇਰੈਂਟਸ ਮੈਨੂੰ ਵਰਿੰਦਾਵਨ ਲੈ ਕੇ ਗਏ ਸੀ ਅਤੇ ਉੱਥੇ ਮੈਂ ਆਪਣੀ ਕਾਫੀ ਵਧੀਆ ਵਧੀਆ ਐਕਸਪੀ ਮੇਰਾ ਐਕਸੀਪੀਰੀਅੰਸ ਸੀ ਉੱਥੇ ਮੈਂ ਈਸਕੋਣ ਟੈਂਪਲ ਨਿੱਧੀ ਵਣ ਗਈ ਮਾਤਾ ਦਾ ਮੰਦਰ ਗਈ ਹੋਰ ਵੀ ਕਈ ਤਰ੍ਹਾਂ ਦੇ ਬਣ ਹਾਂ ਕ੍ਰਿਸ਼ਨ ਜਨਮ ਭੂ ਭੂਮੀ 'ਤੇ ਮੈਂ ਗਈ ਬਹੁਤ ਵਧੀਆ ਵਧੀਆ ਟੈਂਪਲ ਸੀ ਤਾਂ ਮੈਂ ਬਹੁਤ ਉੱਥੇ ਮਜ਼ੇ ਵੀ ਕੀਤੇ ਉੱਥੇ ਬਾਂਦਰ ਹੁੰਦੇ ਸੀ ਉਹ ਉਹ ਤੁਹਾਡੀ ਚਸ਼ਮੇ ਲੈ ਜਾਂਦੇ ਸੀ ਮੋਬਾਇਲ ਫੋਨ ਲੈ ਜਾਂਦੇ ਸੀ ਉੱਥੇ ਬਾਂਦਰ ਵੀ ਬਹੁਤ ਹੁੰਦੇ ਆ ਅਤੇ ਮੈਨੂੰ ਜਦੋਂ ਨਿੱਧੀ ਵਣ ਗਈ ਸੀ ਉੱਥੇ ਮੈਨੂੰ ਪਤਾ ਚੱਲਿਆ ਕਿ ਜਿਹੜੇ ਕ੍ਰਿਸ਼ਨ ਜੀ ਆ ਉਹ ਰਾਤੀ ਇੱਥੇ ਰਾਸ ਲੀਲਾ ਕਰਦੇ ਆ ਗੋਪੀਆਂ ਨਾਲ ਅਤੇ ਰਾਧਾ ਜੀ ਨਾਲ ਉਹ ਜੋ ਜੋ ਸਵੇਰੇ ਉੱਠਦੇ ਆ ਅਤੇ ਉੱਥੇ ਪ੍ਰਸ਼ਾਦ ਖਾਧਾ ਹੁੰਦਾ ਚੱਦਰ ਬਿਖਰੀ ਹੁੰਦੀ ਹੈ ਅਤੇ ਪਾਣੀ ਪੀਤਾ ਹੁੰਦਾ ਨਿੱਧੀ ਵਣ 'ਚ ਛੋਟੇ ਛੋਟੇ ਪੇੜ ਵੀ ਹੈਗੇ ਉੱਥੇ ਜੋ ਕਿ ਰਾਤੀ ਰਾਧਾ ਕ੍ਰਿਸ਼ਨ ਬਣ ਜਾਂਦੇ ਉਹ ਸੁਣਨ ਨੂੰ ਮਿਲਿਆ ਸੀ ਉੱਥੇ ਵਰਿੰਦਾਵਨ 'ਚ ਅਤੇ ਮੈਂ ਹਾਂ ਛੋਟੇ ਹੁੰਦੇ ਵੀ ਕਾਫੀ ਯਾਤਰਾ ਕੀਤੀਆਂ ਹੋਈਆਂ ਵਾ ਅਤੇ ਪਰ ਸਭ ਤੋਂ ਵਧੀਆ ਮੇਰੀ ਯਾਤਰਾ ਵਰਿੰਦਾਵਨ ਦੀ ਸੀ ਛੋਟੇ ਹੁੰਦੇ ਅਤੇ ਵਧੀਆ ਸੀ ਐਕਸਪੀਰੀਅੰਸ ਮੇਰਾ ਧੰਨਵਾਦ